ਮਰਦਾਂ ਵਿੱਚ ਪਹਿਨੇ ਜਾਣ ਵਾਲੇ ਰਿਵਾਇਤੀ ਪਹਿਰਾਵੇ ਕੁੜਤਾ ਪਜਾਮਾ ਤੁਰਲੇ ਵਾਲੀ ਪੱਗ ਅਤੇ ਪੈਰੀਂ ਜੁੱਤੀ ਅਤੇ ਔਰਤਾਂ ਵਿੱਚ ਪਹਿਨੇ ਜਾਣ ਵਾਲੇ ਪੰਜਾਬੀ ਸੂਟ ਪੰਜਾਬੀ ਸੂਟ ਜੁੱਤੀਆਂ ਪਹਿਨਦੀਆਂ ਹਨ ਆਮ ਔਰਤਾਂ ਪਹਿਨਦੀਆਂ ਹਨ ਅਤੇ ਪਹਿਲਾਂ ਤਾਂ ਹੁਣ ਤਾਂ ਅੱਜ ਕੱਲ੍ਹ ਤਾਂ ਪਿੰਡਾਂ ਵਿੱਚ ਬਹੁਤ ਘੱਟ ਮਤਲਬ ਪੰਜਾਬੀ ਸੂਟ ਪਹਿਨਦੀਆਂ ਹਨ ਔਰਤਾਂ ਕਿਉਂਕਿ ਅੱਜ ਕੱਲ੍ਹ ਜ਼ਿਆਦਾਤਰ ਇਹ ਟੋਪ ਵਗੈਰਾ ਜੀਨਾਂ ਵਗੈਰਾ ਪਾਉਂਦੇ ਹਨ ਜਾਂ ਕੋਈ ਆਮ ਕੱਪੜੇ ਮਤਲਬ ਪਾਂਦੇ ਹਨ ਜਿੰਨ੍ਹਾਂ ਵਿੱਚ ਇਹ ਸੋਖੇ ਰਹਿ ਸਕਣ ਕਿਉਂਕਿ ਪਹਿਲਾਂ ਸਾਡੇ ਪੰਜਾਬੀਆਂ 'ਚ ਸੀ ਕਿ ਹਰ ਮਰਦਾਂ ਅਤੇ ਔਰਤਾਂ ਦਾ ਅਲੱਗ ਅਲੱਗ ਪਹਿਰਾਵਾ ਹੁੰਦਾ ਸੀਗਾ ਕਿ ਜਿਹੜੀਆਂ ਔਰਤਾਂ ਹੈਗੀਆਂ ਜਿਵੇਂ ਇਹ ਪਿੰਡਾਂ ਵਿੱਚ ਸਾਉਣ ਵਿੱਚ ਤੀਆਂ ਲੱਗਦੀਆਂ ਸਨ ਅਤੇ ਆਪਣੇ ਪੰਜਾਬੀ ਸੂਟ ਪਾ ਕੇ ਅਤੇ ਜਾਂਦੀਆਂ ਸਨ ਤਾਂ ਕਿ ਇਹ ਮਤਲਬ ਇਹ ਸਾਡਾ ਪੰਜਾਬੀ ਵਿਰਸੇ ਨਾਲ ਜੁੜੀਆਂ ਰਹਿਣ ਅੱਜ ਕੱਲ੍ਹ ਸਮੇਂ ਦੇ ਹਿਸਾਬ ਨਾਲ ਜੋ ਕਿ ਪੰਜਾਬੀ ਹੈ ਪਿੰਡਾਂ ਵਾਲੇ ਇਹ ਵੀ ਬਦਲ ਗਏ ਹਨ ਕਿਉਂਕਿ ਇਹ ਤਾਂ ਇੱਕ ਤਿਉਹਾਰਾਂ 'ਤੇ ਹੀ ਪੰਜਾਬੀ ਸੂਟ ਪਾ ਸਕਦੇ ਹਨ ਜੇ ਅਤੇ ਜਦੋਂ ਗੁਰੂ ਸਾਹਿਬ ਘਰ ਵਗੈਰਾ ਜਾਂਦੇ ਹਨ ਅਤੇ ਉਦੋਂ ਇਹ ਪੰਜਾਬੀ ਸੂਟ ਪਾ ਸਕਦੇ ਹਨ ਜਿਹੜੇ ਮਰਦ ਹੈ ਇਹ ਆਪਣਾ ਕੁੜਤਾ ਪਜਾਮਾ ਅਤੇ ਤੁਰਲੇ ਵਾਲੀ ਪੱਗ ਬੰਨ ਕੇ ਅਤੇ ਸਾਉਣ ਦੇ ਵਿੱਚ ਕੋਈ ਵੀ ਜਦੋਂ ਮੇਲਾ ਵਗੈਰਾ ਲੱਗਦਾ ਸੀ ਅਤੇ ਉਦੋਂ ਪੰਜਾਬੀ ਆਪਣੇ ਵੱਖ ਹੀ ਵੱਖਰੇ ਹੀ ਤਰੀਕੇ ਨਾਲ ਪੇਸ਼ ਹੁੰਦਾ ਸੀ ਕਿਉਂਕਿ ਉਹ ਚਾਦਰਾ ਬੰਨਦਾ ਹੁੰਦਾ ਸੀ ਅਤੇ ਆਪਣਾ ਸਿਰ 'ਤੇ ਤੁਰਲੇ ਵਾਲੀ ਪੱਗ ਬੰਨਦਾ ਹੁੰਦਾ ਸੀ ਅਤੇ ਹੁਣ ਇਹ ਨਹੀਂ ਰਿਹਾ ਇਹ ਸਭ ਕੁਛ ਸਮੇਂ ਦੇ ਹਿਸਾਬ ਨਾਲ ਖ਼ਤਮ ਹੁੰਦਾ ਜਾਂਦਾ ਰਿਹਾ ਅੱਜ ਕੱਲ੍ਹ ਲੋਕ ਮੋਡਰਨ ਤਰੀਕੇ ਨਾਲ ਰਹਿਣ ਲੱਗ ਗਏ ਹਨ